ਤਕਨਾਲੋਜੀ ਨੇ ਇਸ ਸਮੇਂ ਜ਼ਿੰਦਗੀ ਬਹੁਤ ਬਦਲ ਦਿੱਤੀ ਹੈ ਕਿਉਂਕਿ ਮੋਬਾਇਲ ਰਾਹੀਂ ਅਸੀਂ ਇੱਕ ਦੂਏ ਨੂੰ ਪੈਸੇ ਸ਼ਿਫਟ ਕਰ ਦਿੰਦੇ ਹਨ ਅਤੇ ਬੈਂਕਾਂ ਰਾਹੀਂ ਵੀ ਜੋ ਪਹਿਲਾਂ ਟਾਇਮ ਲੱਗਦਾ ਸੀ ਉਹ ਛੇਤੀ ਉਹਦੀ ਬ ਸਮੇਂ ਦੀ ਵੀ ਬੱਚਤ ਹੁੰਦੀ ਹੈ ਅਤੇ ਕਿਸੇ ਨੂੰ ਸਮਾਨ ਲੈਣਾ ਕਰਿਆਨਾ ਲੈਣਾ ਉਹ ਸਮੇਂ ਸਿਰ ਮੋਬਾਇਲ ਰਾਹੀਂ ਭੁਗਤਾਨ ਕਰ ਦਿੱਤਾ ਜਾਂਦਾ ਹੈ ਅਤੇ ਹੋਰ ਵੀ ਕੋਈ ਵੀ ਚੀਜ਼ ਖਰੀਦਣੀ ਆ ਅਤੇ ਟਿਕਟਾਂ ਲੈਣੀਆਂ ਹਵਾਈ ਸਫ਼ਰ ਕਰਨਾ ਮੋਬਾਇਲ ਰਾਹੀਂ ਟਿਕਟ ਬੁੱਕ ਹੋ ਜਾਂਦੀ ਹੈ ਟੈਕਨੋਲਜੀ ਕਾਰ ਕਾਰਨ ਸਮੇਂ ਦੀ ਬਹੁਤ ਬੱਚਤ ਹੋ ਗਈ ਹੈ ਅਤੇ ਆਉਣਾ ਜਾਣਾ ਵੀ ਅਤੇ ਖਰਚਾ ਵੀ ਘੱਟ ਗਿਆ ਹੈ